ਸ਼ੋਸ਼ਲ ਮੀਡੀਆ ਦੇ ਐਪ ਦੇ ਥਰੂ ਬਹੁਤ ਜ਼ਿਆਦਾ ਖਾਤੇ ਹੁੰਦੇ ਹਨ ਜਿਵੇਂ ਕਿ ਗੂਗਲ ਪੇ ਯੂਟਿਊਬ 'ਤੇ ਵੀ ਖਾਤਾ ਹੁੰਦਾ ਹੈ ਜ਼ੂਮ ਐਪ ਇਨ੍ਹਾਂ ਐਪਸ ਦੀ ਮਦਦ ਅਸੀਂ ਵੱਖ ਵੱਖ ਫਾਇਦਿਆ ਲਈ ਕਰਦੇ ਹਾਂ ਜਿਵੇਂ ਜਿਨ੍ਹਾਂ ਤੋਂ ਸਾਨੂੰ ਬਹੁਤ ਹੀ ਜ਼ਿਆਦਾ ਮਦਦ ਮਿਲਦੀ ਹੈ ਜਿਵੇਂ ਕਿ ਗੂਗਲ ਪੇ ਜਾਂ ਪੇਟੀਐੱਮ ਦੀ ਵਰਤੋਂ ਅਸੀਂ ਪੈਸੇ ਦੇ ਅਦਾਨ ਪ੍ਰਦਾਨ ਲਈ ਕਰਦੇ ਹਾਂ ਜੋ ਕਿ ਸਾਨੂੰ ਬਹੁਤ ਹੀ ਅਸਾਨ ਹੋ ਜਾਂਦਾ ਹੈ ਔਰ ਯੂਟਿਊਬ ਦੀ ਵਰਤੋਂ ਅਸੀਂ ਉੱਥੇ ਵੀਡੀਓਜ਼ ਦੇਖਣ ਲਈ ਮਦਦ ਕਰਦੇ ਹਾਂ ਜਿਵੇਂ ਕਿ ਸਾਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉੱਥੇ ਬਹੁਤ ਹੀ ਜ਼ਿਆਦਾ ਵੀਡੀਓਜ਼ ਦਿੱਤੀਆਂ ਜਾਂਦੀਆ ਹਨ ਜਿਨ੍ਹਾਂ ਤੋਂ ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ ਅਤੇ ਉਸ ਤੋਂ ਅਸੀਂ ਇੱਥੋਂ ਪੈਸੇ ਵੀ ਕਮਾਂ ਸਕਦੇ ਹਾਂ ਇਹ ਵੀਡੀਓ ਬਣਾ ਕੇ ਔਰ ਗੂਗਲ ਵਿੱਚ ਅਸੀਂ ਕਿਸੇ ਵੀ ਚੀਜ਼ ਦਾ ਹੱਲ ਲੱਭ ਸਕਦੇ ਹਾਂ ਇੱਥੇ ਸਰਚ ਬੋਕਸ ਹੁੰਦਾ ਹੈ ਜਿਹਦੇ ਵਿੱਚ ਅਸੀਂ ਆਪਣੀ ਪ੍ਰੋਬਲਮ ਦੱਸਦੇ ਹਾਂ ਅਤੇ ਉਸਦਾ ਸਲਿਊਸ਼ਨ ਸਾਨੂੰ ਦੇ ਦਿੱਤਾ ਜਾਂਦਾ ਹੈ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਖਾਤੇ ਹਨ ਜ਼ੂਮ ਐਪ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨਾਲ ਇੱਕੋ ਹੀ ਟਾਈਮ 'ਤੇ ਇੱਕ ਮੀਟਿੰਗ ਕੰਡਕਟ ਕਰ ਸਕਦੇ ਹਾਂ ਜੋ ਕਿ ਸਾਡੇ ਲਈ ਬਹੁਤ ਹੀ ਲਾਭਕਾਰੀ ਹੁੰਦੀ ਹੈ ਇੱਕ ਟਾਈਮ 'ਤੇ ਅਸੀਂ ਇੰਨੇ ਜਣਿਆ ਨਾਲ ਗੱਲ ਕਰ ਸਕਦੇ ਹਾਂ ਜੋ ਕਿ ਸਾਡਾ ਟਾਈਮ ਵੀ ਬਚਾਉਂਦੀ ਹੈ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਐਪਸ ਨਾਲ ਅਸੀਂ ਬਹੁਤ ਮਦਦ ਲੈ ਸਕਦੇ ਹਾਂ ਧੰਨਵਾਦ